ਭਾਰਤ ਵਿੱਚ ਭਾਂਤ ਭਾਂਤ ਦੀਆਂ ਥਾਵਾਂ ਹਨ ਪਰ ਮੇਰੇ ਹਿਸਾਬ ਨਾਲ਼ ਦੋ ਥਾਵਾਂ 'ਤੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਪਹਿਲੀ ਹੈ ਪੰਜਾਬ ਪੰਜਾਬ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਇੱਥੇ ਪੰਜਾਬ ਦਾ ਇਤਿਹਾਸ ਬਹੁਤ ਹੀ ਅਨੌਖਾ ਅਤੇ ਵਰਣਨ ਯੋਗ ਹੈ ਤੁਸੀਂ ਅੰਮ੍ਰਿਤਸਰ ਵਿੱਚ ਆਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਸਿੱਖ ਇਤਿਹਾਸ ਬਾਰੇ ਅਤੇ ਪੰਜਾਬ ਦੇ ਲੋਕਾਂ ਦੀਆਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਅਤੇ ਦੂਜਾ ਹੈ ਭਾਰਤ ਵਿੱਚ ਆਗਰਾ ਆਗਰੇ ਦੇ ਵਿੱਚ ਤੁਸੀਂ ਮੁਗਲਾਂ ਦੁਆਰਾ ਬਣਾਇਆ ਗਿਆ ਤਾਜ ਮਹਿਲ ਹੈ ਜੋ ਕਿ ਇੱਕ ਪਿਆਰ ਦੀ ਨਿਸ਼ਾਨੀ ਹੈ ਤਾਜ ਮਹਿਲ ਸ਼ਾਹਜਹਾਨ ਵੱਲੋਂ ਬਣਾਇਆ ਗਿਆ ਸੀ ਜੋ ਕਿ ਉਸਦੀ ਬੇਗ਼ਮ ਮੁਮਤਾਜ ਦੀ ਯਾਦ ਵਿੱਚ ਬਣਾਇਆ ਗਿਆ ਸੀ ਉਸਨੇ